ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪਾਉਂਦਾ ਹਾਂ ਅਤੇ ਅੱਗੋਂ ਵੀ ਰਿਸ਼ਤੇਦਾਰ ਵੀ ਤਸਵੀਰਾਂ ਪਾਉਂਦੇ ਨੇ ਜਿਵੇਂ ਫੇਸਬੁਕ ਹੈ ਫੇਸਬੁਕ 'ਤੇ ਵੀ ਕਨੈਕਵਿਟੀ ਬਣੀ ਰਹਿੰਦੀ ਹੈ ਆਪਣੇ ਰਿਸ਼ਤੇਦਾਰਾਂ ਨਾਲ ਦੋਸਤਾਂ ਨਾਲ ਵਟਸਐਪ 'ਤੇ ਵੀ ਗਰੁੱਪ ਬਣੇ ਹੋਏ ਨੇ ਉਹਨਾਂ ਨਾਲ ਵੀ ਆਪਣੇ ਰਿਸ਼ਤੇਦਾਰਾਂ 'ਚ ਦੋਸਤਾਂ ਨਾਲ ਅਤੇ ਹੋਰ ਲੋਕਾਂ ਨਾਲ ਵੀ ਕਨੈਕਟਿਵਟੀ ਬਣੀ ਰਹਿੰਦੀ ਹੈ